ਗਿਆਰ੍ਹਾਂ ਦੋ ਸੌ ਪੱਚੀ ਤਿੰਨ ਹਜ਼ਾਰ ਇੱਕ ਸੌ ਪੱਚੀ ਬਿਆਲੀ ਹਜ਼ਾਰ ਤਿੰਨ ਸੌ ਇੱਕਾਹਠ ਪੰਜ ਲੱਖ ਚੌਂਤੀ ਹਜ਼ਾਰ ਅੱਠ ਸੌ ਦਸ